ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਨਾ ਆਪਣੇ ਬੱਚੇ ਨੂੰ ਸਕੂਲ ਪਾਉਣਾ ਸੀਗਾ ਅਤੇ ਤੁਹਾਡੇ ਨਾਲ ਸਲਾਹ ਕਰਨੀ ਆ ਵੀ ਤੁਸੀਂ ਵੀ ਕਹਿੰਦੇ ਸੀਗੇ ਕਿ ਆਪਣੇ ਬੱਚੇ ਨੂੰ ਪਾਉਣਾ ਹੈ ਸਕੂਲ ਅਤੇ ਆਪਾਂ ਕਿਹੜੇ ਸਕੂਲ 'ਚ ਪਾਈਏ

ਹਾਂ ਪੀ ਸੀ ਏ ਦੇ ਵਿੱਚ ਨਾ ਹਾਂ ਪੀ ਸੀ ਏ ਦੇ ਵਿੱਚ ਮੇਰੀ ਇੱਕ ਸਿਸਟਰ ਆ ਉਹ ਉਹ ਵੀ ਉੱਥੇ ਪੜਾਉਂਦੇ ਆ ਹਾਂ ਅਤੇ ਉਹਨਾਂ ਨੇ ਮੈਨੂੰ ਦੱਸਿਆ ਸੀ ਕਹਿੰਦੇ ਸੀਗੇ ਪੀ ਸੀ ਏ ਦੇ ਵਿੱਚ ਬਹੁਤ ਮਤਲਬ ਟੈਲੈਂਟਡ ਹੈਗੇ ਆ ਟੀਚਰ ਬਹੁਤ ਵਧੀਆ ਪੜਾਉਂਦੇ ਆ ਉੱਥੇ ਅਤੇ ਹਾਂਜੀ

ਹਾਂਜੀ ਅਤੇ ਆਪਾਂ ਇਸ ਤਰ੍ਹਾਂ ਹੀ ਕਰਕੇ ਨਾ ਸਲਾਹ ਅਤੇ ਇੱਕ ਦਿਨ ਚੱਲੀਏ ਆਪਾਂ ਅਤੇ ਬੱਚੇ ਦਾਖ਼ਲ ਕਰਵਾ ਆਈਏ ਐਡਮਿਸ਼ਨ ਕਰਵਾ ਆਈਏ ਉਹਨਾਂ ਦੀ ਪੀ ਸੀ ਏ ਹਾਂਜੀ ਚਲੋ ਠੀਕ ਮਿਲਦੇ ਹਾਂ ਜੀ ਓਕੇ